ਅੱਜ ਕੱਲ੍ਹ ਬਹੁਤ ਸਾਰੀਆਂ ਵਰਤਣ ਵਾਲੀਆਂ ਐਪਸ ਨੇ ਜਿਹਦੇ ਥਰੂ ਆਪਾਂ ਆਪਣੇ ਟੈਕਸਟ ਅਤੇ ਸੁਨੇਹੇ ਭੇਜ ਸਕਦੇ ਹਾਂ ਟੈਕਸ ਦੇ ਥਰੂ ਤਾਂ ਦਸਤਾਵੇਜ ਵੀ ਭੇਜ ਸਕਦੇ ਹਾਂ ਸਿੱਧੇ ਸਿੱਧੇ ਡਾਕੂਮੈਂਟਸ ਪੀ ਡੀ ਐੱਫ ਫਾਈਲ 'ਚ ਵੀ ਭੇਜ ਸਕਦੇ ਹਾਂ ਵਰਡ ਫਾਈਲ 'ਚ ਵੀ ਭੇਜ ਸਕਦੇ ਹਾਂ ਉਹਨਾਂ ਵਿੱਚੋਂ ਇੱਕ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਹੈਗਾ ਵਟਸਐਪ ਹੈ ਨਾ ਆਪਾਂ ਵਟਸਐਪ ਦੇ ਥਰੂ ਆਪਣੀ ਇਨਫੋਰਮੇਸ਼ਨ ਕਿਤੇ ਵੀ ਜਿਹੜੀ ਆ ਉਹ ਟ੍ਰਾਂਸਫਰ ਕਰ ਸਕਦੇ ਹਾਂ ਹੈ ਨਾ ਡਾਕੂਮੈਂਟਸ ਵੀ ਭੇਜ ਸਕਦੇ ਹਾਂ ਕੁਛ ਵੀ ਕਰ ਸਕਦੇ ਹਾਂ ਈਵਨ ਅੱਜ ਕੱਲ੍ਹ ਤਾਂ ਉਹ 'ਤੇ ਪੈਸੇ ਮੰਗਵਾਉਣ ਦੀ ਵੀ ਸੁਵਿਧਾ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਅਤੇ ਇਹਨਾਂ ਨੇ ਜਿਹੜਾ ਮਨੁੱਖੀ ਜੀਵਨ ਨੂੰ ਕਾਫ਼ੀ ਹੱਦ ਤੱਕ ਬਹੁਤ ਜ਼ਿਆਦਾ ਸਰਲ ਜਿਹੜਾ ਉਹ ਕਰ ਦਿੱਤਾ ਵੈ ਅਤੇ ਇਹਨਾਂ ਨਾਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਾਨੂੰ ਫਸੈਲਿਟੀਸ ਮਿਲ ਰਹੀਆਂ ਨੇ ਹੋਰ ਵੀ ਬਹੁਤ ਸਾਰੇ ਨੇ ਜਿਵੇਂ ਟੈਲੀਗ੍ਰਾਮ ਹੈ ਫੇਸਬੁੱਕ ਹੈ ਇੰਸਟਾਗ੍ਰਾਮ ਹੈ ਇਹ ਸਾਰੀਆਂ ਸੁਵ ਮਤਲਬ ਇਹਨਾਂ ਸਾਰੀਆਂ ਦੇ ਥਰੂ ਵੀ ਆਪਾਂ ਜਿਹੜੀ ਆ ਉਹ ਆਪਣੀ ਜਿਹੜੇ ਗੱਲਬਾਤ ਹੈਗੀ ਆ ਉਹ ਦੂਸਰੇ ਤੱਕ ਪਹੁੰਚਾ ਸਕਦੇ ਹਾਂ ਇਹਨਾਂ ਨੇ ਸਾਡੇ ਮਨੁੱਖ ਸਾਡੇ ਮਨੁੱਖੀ ਜੀਵਨ ਨੂੰ ਬਹੁਤ ਸਰਲ ਬਣਾ ਦਿੱਤਾ ਹੈ ਲੇਕਿਨ ਬਹੁਤ ਸਾਰੀਆਂ ਸੁਵਿਧਾਵਾਂ ਵੀ ਕ੍ਰੀਏਟ ਕੀਤੀਆਂ ਨੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਗਏ ਹਾਂ ਆਪਾਂ ਆਹ ਟੋਟਲੀ ਇਹਨਾਂ ਚੀਜ਼ਾਂ 'ਤੇ ਡਿਪੈਂਡੈਂਟ ਹੋ ਗਏ ਹਾਂ ਅਸੀਂ ਕਿਤੇ ਜਾਣਾ ਵੀ ਹੈ ਕੁਛ ਕਰਨਾ ਵੀ ਹੈ ਅਤੇ ਅਸੀਂ ਹੋਰ ਕੋਈ ਮੀਮਾ ਮਤਲਬ ਮੀਡੀਅਮ ਜਿਹੜਾ ਯੂਜ਼ ਹੀ ਨਹੀਂ ਕਰਦੇ ਆਪਾਂ ਹਮੇਸ਼ਾ ਵਸਟਐਪ ਨੂੰ ਯੂਜ ਕਰਨਾ ਜਿਹੜਾ ਉਹ ਪ੍ਰੈਫਰ ਸਭ ਕਰਦੇ ਆ ਕਿ ਵੀ ਚਲੋ ਆਪਾਂ ਵਸਟਐਪ ਦੇ ਥਰੂ ਮੈਸੇਜ ਕਰ ਦਿੰਦੇ ਆ ਡਾਕੂਮੈਂਟ ਭੇਜ ਦਿੰਦੇ ਆ ਕੋਈ ਵੀ ਇਨਫੋਰਮੇਸ਼ਨ ਹੈਗੀ ਉਹ ਵੀ ਉਹਦੇ ਥਰੂ ਹੀ ਭੇਜਣੀ ਜਿਹੜੀ ਉਹ ਪ੍ਰੈਫਰ ਕਰਦੇ ਹਾਂ ਈਵਨ ਇਹਨਾਂ ਦੇ ਥਰੂ ਸਾਡੀ ਪਰਸਨਲ ਇਨਫੋਰਮੇਸ਼ਨ ਵੀ ਲੀਕ ਹੋਣ ਦੇ ਚਾਂਸ ਹੁੰਦੇ ਨੇ ਵੈਸੇ ਤਾਂ ਐਂਡ ਟੂ ਐਂਡ ਇਨਕ੍ਰਿਪਸ਼ਨ ਜਿਹੜੀ ਉਹ ਲਿਖਿਆ ਹੁੰਦਾ ਆਉਂਦਾ ਹੈ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਉਹ ਐਂਡ ਟੂ ਐਂਡ ਇਨਕ੍ਰਿਪਸ਼ਨ ਹੁੰਦੀ ਸਾਡੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਕਾਫ਼ੀ ਹੱਦ ਤੱਕ ਜਿਹੜੀ ਆ ਉਹ ਲੀਕ ਹੋ ਜਾਂਦੀ ਹੈ ਈਵਨ ਕਿ ਆਪਾਂ ਡਾਟਾ ਭੇਜਣ ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਮਤਲਬ ਜਿਵੇਂ ਆਪਾਂ ਜਿਹੜਾ ਡਾਟਾ ਭੇਜਦੇ ਹਾਂ ਉਹ ਸੇਮ ਐਡੀਟਿੰਗ ਵਾਲਾ ਨਹੀਂ ਰਹਿੰਦਾ ਆਪਾਂ ਕਿਸੇ ਨੂੰ ਜੇ ਇਹਦੇ ਥਰੂ ਮੈਸੇਜ ਭੇਜਦੇ ਹਾਂ ਨਾ ਜਿਵੇਂ ਵਟਸਐਪ ਦੇ ਥਰੂ ਕੋਈ ਮੀਡੀਅਮ ਮਤਲਬ ਭੇਜ ਰਹੇ ਹੈ ਨਾ ਸਪੋਸ ਕਰੋ ਮੈਂ ਵਰਡ ਦੀ ਫਾਈਲ ਭੇਜਣੀ ਆ ਅਤੇ ਉਹ ਜਿਹੜਾ ਸੇਮ ਨਹੀਂ ਰਹੇਗਾ ਉਹ ਦੂਸਰੇ ਤੱਕ ਜਾਂਦੇ ਜਾਂਦੇ ਉਹਦੀ ਸਾਰੀ ਐਡਿਟਿੰਗ ਆ ਉਹ ਹਿਲ ਜਾਂਦੀ ਹੈ ਅਤੇ ਕਹਿੰਦਾ ਕਿ ਕਾਫ਼ੀ ਜ਼ਿਆਦਾ ਜਿਹੜਾ ਮਤਲਬ ਇਹਨਾਂ ਨੇ ਜਿਹੜਾ ਉਹ ਪ੍ਰੋਬਲਮਸ ਵੀ ਕ੍ਰੀਏਟ ਕੀਤੀਆਂ ਨੇ ਹਾਂ ਮਨੁੱਖੀ ਜੀਵਨ ਨੂੰ ਬਹੁਤ ਸਰਲ ਵੀ ਬਣਾਇਆ ਲੇਕਿਨ ਕੁਛ ਹੱਦ ਤੱਕ ਇਹਨੇ ਕਾਫ਼ੀ ਪ੍ਰੋਬਲਮਸ ਵੀ ਜਿਹੜੀਆਂ ਉਹ ਕ੍ਰੀਏਟ ਕਰ ਦਿੱਤੀਆਂ ਨੇ